ਹਾਂਜੀ ਦਲਜਿੰਦਰ ਸਿੰਘ ਜੀ ਗੱਲ ਕਰ ਰਹੇ ਹੋ ਹਾਂਜੀ ਸਰ ਮੈਂ ਗੁਰਦੀਪ ਸਿੰਘ ਗੱਲ ਕਰ ਰਿਹਾ ਮੁਕਤਸਰ ਤੋਂ ਹਾਂਜੀ ਹਾਂ ਹੁਕਮ ਸਰ ਇਦਾਂ ਜੀ ਮੇਰਾ ਨਾ ਕਿਸੇ ਫਰੈਂਡ ਨੇ ਥੋੜਾ ਨੰਬਰ ਦਿੱਤਾ ਸੀਗਾ ਤੇ ਆਪਾਂ ਨਾ ਆਪਾਂ ਇੱਕ ਇੱਕ ਨਾ ਮੁਕਤਸਰ ਸ਼ੌਪ ਖੋਲਣੀ ਆ ਜੀ ਤੇ ਉਹਦੇ ਲਈ ਨਾ ਹੀ ਆਪਾਂ ਨੂੰ ਸਮਾਨ ਵਗੈਰਾ ਚਾਹੀਦਾ ਤੇ ਮੇਰੇ ਦੋਸਤ ਨੇ ਦੱਸਿਆ ਸੀਗਾ ਵੀ ਦਿੱਲੀ ਤੋਂ ਬਹੁਤ ਵਧੀਆ ਸਮਾਨ ਮਿਲਦਾ ਹੈਗਾ ਤੇ ਸਸਤੇ ਰੇਟਾਂ ਚ ਮਿਲਦਾ ਜਿਹੜਾ ਕੀ ਆਪਾਂ ਨੂੰ ਬੈਨੀਫਿਟ ਦੇ ਸਕੇ ਤੇ ਤੁਸੀਂ ਮੈਨੂੰ ਦੱਸੋਗੇ ਸਰ ਕਿੱਥੋਂ ਕੁ ਤੁਸੀਂ ਮੈਨੂੰ ਸਮਾਨ ਦਵਾ ਸਕਦੇ ਹੋ ਇਹ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਐ ਨਾ ਜੀ ਆਪਾਂ ਹੁਣ ਨਵਾਂ ਕੰਮ ਕਰਨ ਲੱਗੇ ਆ ਮੰਨ ਕੇ ਚਲੋ ਵਿੱਚ ਮਨਿਆਰੀ ਦਾ ਸਮਾਨ ਵੀ ਰੱਖਾਂਗੇ ਜੀ ਠੀਕ ਹ ਜੀ ਮਨਿਆਰੀ ਦਾ ਸਮਾਨ ਰੱਖਾਂਗੇ ਤੇ ਕੁਛ ਇੱਕ ਨਾ ਇਧਰ ਸਾਡੇ ਮੂਰਤੀਆਂ ਵਗੈਰਾ ਜਿਆਦਾ ਵਿਕਦੀਆਂ ਜਿਵੇਂ ਜਾਨੀ ਕੀ ਵੀ ਥੋੜੀ ਯੁਨੀ ਯੂਨੀਕ ਜਿਹੇ ਪੀਸ ਤੇ ਪੀਸ

ਓਹਦੇ ਬਾਰੇ ਚਾਨਣਾ ਪਾਓ ਮੈਨੂੰ ਕੁਛ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਤੇ ਸਰ ਦੋ ਦੋ ਦਿਨਾਂ ਦੇ ਵਿੱਚ ਵਿੱਚ ਟਾਈਮ ਲੱਗ ਸਕਦਾ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਮੁਕਤਸਰ ਤੋਂ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਚਲੋ ਵਧੀਆ ਤੁਸੀਂ ਆ ਵੀ ਚੀਜ ਦੱਸਤੀ ਜੀ ਮੈਂ ਆਪਣੇ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਚਲੋ ਵਧੀਆ ਤੁਸੀਂ ਤੁਸੀਂ ਹਾਂਜੀ ਹਾਂਜੀ ਚਲੋ ਵਧੀਆ ਤੁਸੀਂ ਮੈਨੂੰ ਦੱਸਤਾ ਜੀ ਤੇ ਮੈਨੂੰ ਨਾ ਮੈਂ ਪੁੱਛਣਾ ਹੀ ਸੀਗਾ ਟ੍ਰੇਨ ਦਾ ਵੀ ਚਲੋ ਤੁਸੀਂ ਵਧੀਆ ਮੈਨੂੰ ਦੱਸਤਾ ਚਲੋ ਵੀ ਮੈਨੂੰ ਹਾਂਜੀ ਹਾਂਜੀ ਹਾਂਜੀ ਤੇ ਸਰ ਫਿਰ ਤੁਸੀਂ ਟਾਈਮ ਕੱਢੋ ਜੀ ਤੇ ਮੈਨੂੰ ਨਾ ਤੁਸੀਂ ਵੀ ਇਹ ਚੀਜ਼ਾਂ ਤੁਸੀਂ ਹੁਣ ਦਬਾਉਣੀਆਂ ਕਿੱਥੋਂ ਕਿੱਥੋਂ ਵਧੀਆ ਮਿਲਦੀਆਂ ਕੋਈ ਯੂਨੀਕ ਜਿਹੇ ਪੀਸ ਹਾਂਜੀ ਹਾਂਜੀ ਕੱਲ ਸ਼ਾਮ ਨੂੰ ਜੀ

ਚਲੋ ਠੀਕ ਹੈ ਸਰ ਫਿਰ ਮੈਂ ਨਾ ਣੈਨੂੰ ਨਾ ਇੱਕ ਕੋਲ ਆ ਰਹੀ ਆ ਤੇ ਮੈਂ ਹਾਂਜੀ ਠੀਕ ਓਕੇ ਸਰ